ਹੈਲੋ ਮੈਂ ਪਟਿਆਲਾ ਜ਼ਿਲ੍ਹੇ ਤੋਂ ਪ੍ਰਭਜੋਤ ਕੌਰ ਗੱਲ ਕਰ ਰਹੀ ਹਾਂ ਮੈਂ ਪਿਛਲੇ ਹਫਤੇ ਆਪ ਜੀ ਦੀ ਕੰਪਨੀ ਤੋਂ ਇੱਕ ਜੈਕਟ ਆਡਰ ਕੀਤਾ ਸੀ ਸਾਈਟ ਉੱਤੇ ਦੇਖੇ ਅਨੁਸਾਰ ਅਤੇ ਔਡਰ ਕਰਨ ਅਨੁਸਾਰ ਇਹ ਜੈਕਿਟ ਬਹੁਤ ਵਧੀਆ ਨਿਕਲਿਆ ਮੈਂ ਬਰਾਊਨ ਰੰਗ ਦਾ ਜੈਕਟ ਔਡਰ ਕੀਤਾ ਸੀ ਅਤੇ ਇਹ ਮੇਰੇ ਦੇਖੇ ਅਨੁਸਾਰ ਅਤੇ ਪਸੰਦ ਕੀਤੇ ਅਨੁਸਾਰ ਹੀ ਨਿਕਲਿਆ ਜੈਕਿਟ ਦੇ ਕੱਪੜੇ ਦੀ ਕੁਆਲਿਟੀ ਬਹੁਤ ਵਧੀਆ ਹੈ ਇਸ ਦੇ ਉੱਪਰ ਲੱਗੇ ਟੈਗ ਅਤੇ ਜ਼ਿਪ ਵੀ ਬਹੁਤ ਸੁੰਦਰ ਹਨ ਮੈਨੂੰ ਇਹ ਜੈਕਿਟ ਬਹੁਤ ਪਸੰਦ ਆਇਆ ਇਸ ਦੀ ਡਿਲੀਵਰੀ ਵੀ ਬਹੁਤ ਸਮੇਂ ਸਿਰ ਹੋਈ ਅਤੇ ਇਸ ਦਾ ਮੁੱਲ ਵੀ ਠੀਕ ਹੈ ਮੈਨੂੰ ਇਸ ਦੀ ਪੈਕੇਜਿੰਗ ਵੀ ਬਹੁਤ ਪਸੰਦ ਆਈ ਇਸ ਲਈ ਮੈਂ ਆਪ ਜੀ ਦੀ ਕੰਪਨੀ ਨੂੰ ਪ੍ਰੋਸਾਹਿਤ ਕਰਨਾ ਚਾਹੁੰਦੀ ਹਾਂ ਅਤੇ ਆਪ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਗਾਹਕਾਂ ਨੂੰ ਬਹੁਤ ਹੀ ਸੁੰਦਰ ਅਤੇ ਉਹਨਾਂ ਦੀ ਪਸੰਦ ਅਨੁਸਾਰ ਪ੍ਰੋਡਕਟ ਮੁਹੱਈਆ ਕਰਵਾਉਂਦੇ ਹੋ ਆਪ ਜੀ ਦਾ ਧੰਨਵਾਦ